ਸਮਾਨ ਅਤੇ ਯਾਤਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਲੈ ਕੇ ਜਾਣ ਦੀ ਪ੍ਰਕਿਰਿਆ ਨੂੰ ਆਵਾਜਾਈ ਕਹਿੰਦੇ ਹਨ ਆਵਾਜਾਈ ਦੇ ਲਈ ਮਨੁੱਖ ਪਸ਼ੂਆਂ ਅਤੇ ਕਈ ਪ੍ਰਕਾਰ ਦੇ ਵਾਹਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਆਵਾਜਾਈ ਦੇ ਤਿੰਨ ਮੁੱਖ ਢੰਗ ਹਨ ਥਲ ਆਵਾਜਾਈ ਜਲ ਆਵਾਜਾਈ ਅਤੇ ਵਾਯੂ ਆਵਾਜਾਈ ਥਲ ਆਵਾਜਾਈ ਦੇ ਅੰਦਰ ਸੜਕ ਅਤੇ ਰੇਲ ਪਟੜੀ ਦੁਆਰਾ ਆਵਾਜਾਈ ਕੀਤੀ ਜਾਂਦੀ ਹੈ ਜਿਵੇਂ ਰਿਕਸ਼ਾ ਕਾਰ ਸਾਈਕਲ ਸਕੂਟਰ ਟਰੱਕ ਰੇਲਗੱਡੀਆਂ ਅਤੇ ਮੈਟਰੋ ਆਦਿ ਥਾ ਜਲ ਆਵਾਜਾਈ ਵਿੱਚ ਸਮੁੰਦਰ ਮਹਾਸਾਗਰ ਝੀਲਾਂ ਨਹਿਰਾਂ ਨਦੀਆਂ ਆਦਿ ਅਤੇ ਲੋਕਾਂ ਦੇ ਸਮਾਨ ਨੂੰ ਲੈ ਕੇ ਜਾਣ ਦੀ ਪ੍ਰਕਿਰਿਆ ਸ਼ਾਮਿਲ ਹੈ ਇਸ ਦੇ ਅੰਦਰ ਕਿਸ਼ਤੀ ਸਟਰੀਮਰ ਸਮੁੰਦਰੀ ਜਹਾਜ਼ ਬੇੜੇ ਅਤੇ ਪਣਡੁੱਬੀਆਂ ਸ਼ਾਮਿਲ ਹਨ ਇਹ ਸਾਧਨ ਸੜਕ ਅਤੇ ਹਵਾਈ ਆਵਾਜਾਈ ਦੇ ਮੁਕਾਬਲੇ ਹੌਲੀ ਹੈ ਹਵਾਈ ਆਵਾਜਾਈ ਵਿੱਚ ਯਾਤਰੀਆਂ ਅਤੇ ਮਾਲ ਨੂੰ ਹਵਾਈ ਜਹਾਜ਼ ਜਾਂ ਹੈਲੀਕੌਪਟਰ ਦੇ ਜ਼ਰੀਏ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਇਆ ਜਾਂਦਾ ਹੈ ਪਹੀਏ ਦੇ ਆਗਮਨ ਦੇ ਨਾਲ ਮਨੁੱਖ ਦੁਆਰਾ ਉਪਯੋਗ ਕੀਤੇ ਜਾਣ ਵਾਲੇ ਪਹਿਲੇ ਸਾਧਨ ਬੈਲਗੱਡੀਆਂ ਸਨ ਸੜਕ ਮਾਰਗ ਦੇ ਰੂਪ ਵਿੱਚ ਕਾਰਾਂ ਅਤੇ ਬੱਸਾਂ ਦਾ ਉਪਯੋਗ ਬਹੁਤ ਬਾਅਦ ਵਿੱਚ ਹੋਂਦ 'ਚ ਆਇਆ ਅਤੇ ਅੱਜ ਅਸੀਂ ਸੜਕ ਉੱਤੇ ਸਾਈਕਲ ਕਾਰਾਂ ਟਰੱਕ ਆਦਿ ਵਰਤਦੇ ਹਾਂ ਆਵਾਜਾਈ ਦੇ ਸਾਧਨਾਂ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ ਭਾਫ ਇੰਜਣ ਤੋਂ ਬੁਲਿਟ ਟਰੇਨ ਅਤੇ ਰਾਈਟ ਬਰਦਰਜ਼ ਦੁਆਰਾ ਬਣਾਈ ਗਈ ਮਨੁੱਖੀ ਉਡਾਨ ਜੰਬੋ ਜੈਟ ਵੱਲ ਲੈ ਕੇ ਗਈ ਆਵਾਜਾਈ ਦੇ ਕੁਝ ਮੁੱਖ ਰੁਝਾਨ ਹਨ ਖੁਦ ਮੁਖਤਿਆਰ ਵਾਹਨ ਸਵਾਰੀ ਸਾਂਝੇਦਾਰੀ ਵਾਹਨ ਰਿਮੋਟ ਸੈਂਸਰ ਅਣਮਨੁੱਖੀ ਹਵਾਈ ਪ੍ਰਣਾਲੀ ਆਦਿ ਧੰਨਵਾਦ